ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਮੁੱਖ ਖੇਤੀਬਾੜੀ ਉਤਪਾਦ ਅਤੇ ਖੇਤੀ ਅਭਿਆਸ ਵਿੱਚ ਫਸਲ ਪਸ਼ੂ ਧਨ ਸਿੰਚਾਈ ਅਤੇ ਟੈਕਨੋਲਜੀ ਹਨ ਫਸਲ ਵਿੱਚ ਸਾਡੇ ਪੰਜਾਬ ਵਿੱਚ ਫਸਲ ਜਿਵੇਂ ਕਿ ਕਣਕ ਦੀ ਫਸਲ ਮੱਕੀ ਦੀ ਫਸਲ ਝੋਨੇ ਦੀ ਫਸਲ ਉਗਾਈ ਜਾਂਦੀ ਹੈ ਪਸ਼ੂ ਧਨ ਵਿੱਚ ਕਈ ਲੋਕਾਂ ਨੇ ਆਪਣੇ ਘਰਾਂ ਵਿੱਚ ਮੱਝਾਂ ਗਾਵਾਂ ਪਾਲੀਆਂ ਹੋਈਆਂ ਹਨ ਕਈ ਲੋਕਾਂ ਨੇ ਆਪਣੇ ਘਰਾਂ ਵਿੱਚ ਡੇਅਰੀ ਡੇਅਰੀ ਰੱਖੀ ਹੋਈ ਹੈ ਜਿਸ ਕਾਰਨ ਉਹ ਆਪਣਾ ਰੋਜ਼ਗਾਰ ਪ੍ਰਾਪਤ ਕਰਦੇ ਹਨ ਸਿੰਚਾਈ ਦੇ ਸਾਧਨਾਂ ਵਿੱਚ ਜਿਵੇਂ ਕਿ ਲੋਕੀਂ ਪੁਰਾਣੇ ਸਮੇਂ ਵਿੱਚ ਵਰਖਾ ਦੇ ਪਾਣੀ ਉੱਤੇ ਨਿਰਭਰ ਰਹਿੰਦੇ ਸਨ ਅੱਜ ਕੱਲ੍ਹ ਖੇਤਾਂ ਵਿੱਚ ਮੋਟਰਾਂ ਲੱਗੀਆਂ ਹੋਈਆਂ ਹਨ ਜਿਸ ਕਰਕੇ ਮੋਟਰਾਂ ਦੁਆਰਾ ਪਾਣੀ ਜੋ ਹੈ ਕਿ ਖੇਤਾਂ ਵਿੱਚ ਪਹੁੰਚਦਾ ਹੈ ਟੈਕਨੋਲਜੀ ਵਿੱਚ ਜਿਵੇਂ ਫਸਲ ਕੱਟਣ ਲਈ ਪਹਿਲੇ ਹੱਥਾਂ ਨਾਲ ਫਸਲ ਕੱਟੀ ਜਾਂਦੀ ਸੀ ਅੱਜ ਦੇ ਟਾਈਮ ਵਿੱਚ ਟੈਕਨੋਲਜੀ ਨੇ ਇੰਨੀ ਤਰ ਤਰੱਕੀ ਕਰ ਲਈ ਹੈ ਕਿ ਉਹ ਆਪਣੀ ਫਸਲ ਕੰਪੈਨ ਆਦਿ ਨਾਲ ਕਟਵਾਉਂਦੇ ਹਨ ਇਹ ਸਾਡੇ ਪੰਜਾਬ ਵਿੱਚ ਇਸ ਕਰਕੇ ਸਾਡੇ ਪੰਜਾਬ ਵਿੱਚ ਖੇਤੀਬਾੜੀ ਉਤਪਾਦ ਅਤੇ ਖੇਤੀ ਅਭਿਆਸ ਬਹੁਤ ਵੱਧਿਆ ਹੈ